ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਜਗਦੀਸ਼ ਕੁਮਾਰੀ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਇੱਥੇ ਕਾਫੀ ਹੋਸਪੀਟਲ ਹਨ ਪ੍ਰਾਈਵੇਟ ਵੀ ਹੈ ਸਰਕਾਰੀ ਵੀ ਹੈ ਪ੍ਰਾਈਵੇਟ ਵਿੱਚ ਥੋੜ੍ਹਾ ਹੁੰਦਾ ਕਿ ਮਤਲਬ ਕਾਫੀ ਖਰਚਾ ਆ ਜਾਂਦਾ ਹੈ ਉੱਥੇ ਮਰੀਜ਼ ਜਿਹੜਾ ਉਹ ਖਰਚਾ ਨਹੀਂ ਕਰ ਪਾਉਂਦਾ ਸਰਕਾਰੀ ਹੋਸਟਪ ਹੋਸਪਿਟਲਾਂ ਵਿੱਚ ਸਿਰਫ ਤੁਹਾਡੀ ਖੱਜਲ ਖਰਾਬ ਹੀ ਹੁੰਦੀ ਹੈ ਉੱਥੇ ਦਸ ਰੁਪਏ ਦੀ ਪਰਚੀ ਕੱਟੀ ਜਾਂਦੀ ਹੈ ਅਤੇ ਉਹ ਥੋੜ੍ਹੇ ਜਿਹੇ ਪੈਸਿਆਂ ਵਿੱਚ ਦਵਾਈ ਦਾ ਵੀ ਪ੍ਰਬੰਧ ਹੋ ਜਾਂਦਾ ਹੈ ਹੁਣ ਤਾਂ ਕਾਫੀ ਗਲੀ ਮੁਹੱਲੇ ਵਿੱਚ ਵੀ ਨਰਸਿੰਗ ਹੋਮ ਹੈਲਥ ਸਟ ਸਟੇਟ ਵੀ ਹੋਸਪਿਟਲ ਵੀ ਖੁੱਲ੍ਹੇ ਹੋਏ ਹਨ ਜਿੱਥੇ ਕਾਫੀ ਸਹੂਲਤ ਮਿਲਦੀ ਹੈ ਮੁਹੱਲਾ ਕਲੀਨਿੰਕ ਵੀ ਹੈ ਜਿੰਨਾ ਜਿੱਥੇ ਸਭ ਬਹੁਤ ਹੀ ਲੋਕਾਂ ਨੂੰ ਸਹੂਲਤ ਮਿਲਦੀ ਹੈ ਸਾਰਿਆਂ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਉੱਥੇ ਪੈਸੇ ਵੀ ਘੱਟ ਲੱਗਦੇ ਹਨ ਸਾਰਾ ਕੁਛ ਵੀ ਠੀਕ ਹੈ ਟਾਈਮ ਦਾ ਵੀ ਬਹੁਤ ਹੀ ਘੱਟ ਲੱਗਦਾ ਹੈ ਅਤੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਕਿ ਸਾਡੇ ਲਾਗੇ ਕਲੀਨਿਕ ਖੁੱਲ੍ਹਿਆ ਹੈ ਅਸੀਂ ਦਵਾਈ ਲੈਣ ਜਾਂਦੇ ਹਾਂ ਸਾਨੂੰ ਵਧੀਆ ਲੱਗਦਾ ਪੈਸੇ ਵੀ ਘੱਟ ਲੱਗਦੇ ਹਨ ਖਰਚਾ ਬਹੁਤ ਘੱਟ ਆਉਂਦਾ ਹੋਸਪਿਟਲਾਂ ਵਿੱਚ ਬਹੁਤ ਹੀ ਜ਼ਿਆਦਾ ਖਰਚਾ ਆਉਂਦਾ ਹੈ ਕਈ ਲੋਕੀ ਖਰਚਾ ਦੇ ਨਹੀਂ ਪਾਉਂਦੇ ਨਹੀਂ ਕਰ ਪਾਉਂਦੇ ਇਸ ਕਰਕੇ ਸਰਕਾਰੀ ਹੋਸਪੀਟਲ ਬਹੁਤ ਵਧੀਆ ਹੈ ਉੱਥੇ ਟਾਈਮ ਜ਼ਿਆਦਾ ਲੱਗਦਾ ਹੈ ਪਰ ਇਹ ਹੈ ਕਿ ਮਰੀਜ਼ ਨੂੰ ਵਧੀਆ ਲੱਗਦਾ ਹੈ ਥੋੜ੍ਹੇ ਪੈਸਿਆਂ ਵਿੱਚ ਸਾਰਾ ਕੁਛ ਹੋ ਜਾਂਦਾ ਹੈ ਦਵਾਈ ਵੀ ਆ ਜਾਂਦੀ ਹੈ ਸਭ ਕੁਛ ਹੋ ਜਾਂਦਾ ਹੈ ਇਸ ਕਰਕੇ ਮਰੀਜ਼ ਉੱਥੇ ਜਾਣਾ ਜ਼ਿਆਦਾ ਪਸੰਦ ਕਰਦਾ ਹੈ ਸਰਕਾਰੀ ਹੋਸਪਿਟਲ